ਔਨਲਾਈਨ ਸਕੂਲਿੰਗ ਦਾ ਜ਼ਿਆਦਾ ਰੁਝਾਨ ਕੋਵਿਡ ਟਾਈਮ ਵਿੱਚ ਵਧਿਆ ਜਿਸ ਦੇ ਨਾਲ ਬੱਚਿਆਂ ਨੂੰ ਘਰ ਬੈਠਿਆਂ ਹੀ ਸਕੂਲ ਦੇ ਰੋਜ਼ਾਨਾ ਦੇ ਹੋਮਵਰਕ ਫੋਨ ਰਾਹੀਂ ਕਰਨ ਦਾ ਮੌਕਾ ਮਿਲ ਗਿਆ ਤੇ ਬੱਅਚਿਆਂ ਦੀ ਰੋਜ਼ਾਨਾ ਦੀ ਪੜ੍ਹਾਈ ਠੀਕ ਠਾਕ ਚੱਲਦੀ ਰਹੀ ਲੇਕਿਨ ਕੋਵਿਡ ਤੋਂ ਬਾਅਦ ਬੱਚਿਆਂ ਨੂੰ ਮੋਬਾਇਲ ਦੀ ਆਦਤ ਬਣ ਗਈ ਜਿਸ ਕਾਰਨ ਉਹਨਾਂ ਦਾ ਜ਼ਿਆਦਾ ਸਮਾਂ ਮੋਬਾਇਲ ਦੇ ਨਾਲ ਹੀ ਗੁਜ਼ਾਰਦੇ ਨੇ ਜਿਸ ਕਾਰਨ ਉਹਨਾਂ ਦੀਆਂ ਅੱਖਾਂ 'ਤੇ ਕਾਫੀ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਬੱਚਿਆਂ ਦਾ ਆਪਣੇ ਫਰੈਂਡ ਸਰਕਲ ਤੋਂ ਵੀ ਦੂਰੀ ਬਣ ਗਈ ਹੈ ਜੋ ਅੱਜ ਇੱਕ ਦੂਸਰੇ ਨੂੰ ਮਿਲ ਕੇ ਗੱਲਬਾਤ ਰਾਹੀਂ ਗਿਆਨ ਲੈਂਦੇ ਸੀ ਉਹ ਅੱਜ ਸਿਰਫ਼ ਮੋਬਾਇਲ ਤੱਕ ਸੀਮਤ ਹੋ ਗਏ ਇਸ ਕਾਰਨ ਮੋਬਾਈਲ ਦੀ ਵਰਤੋਂ ਜ਼ਰੂਰਤ ਦੇ ਟਾਈਮ 'ਤੇ ਘੱਟ ਤੋਂ ਘੱਟ ਕੀਤੀ ਜਾਣੀ ਚਾਹੀਦੀ ਹੈ ਅਤੇ ਰੋਜ਼ਾਨਾ ਔਨਲਾਈਨ ਸਕੂਲ ਔਫਲਾਈਨ ਸਕੂਲ ਦੇ ਵਿੱਚ ਹੀ ਜਾਣਕਾਰੀ ਲੈਣੀ ਚਾਹੀਦੀ ਹੈ ਜਿੱਥੇ ਆਪਣੇ ਸਾਥੀਆਂ ਦਾ ਟੀਚਰ ਦਾ ਅਤੇ ਸਾਰਿਆਂ ਦਾ ਪਿਆਰ ਔਰ ਗਿਆਨ ਮਿਲਦਾ ਹੈ